ਫੋਟੋਆਂ ਨੂੰ ਸੰਪਾਦਿਤ ਕ ਕਰਨ ਲਈ ਆਪਾਂ ਕੰਪਿਊਟਰ 'ਤੇ ਵੀ ਕਰ ਸਕਦੇ ਹਾਂ ਆਪਾਂ ਆਪਣੇ ਫੋਨ 'ਤੇ ਵੀ ਕਰ ਸਕਦੇ ਹਾਂ ਜਿੱਦਾਂ ਕਿ ਕੰਪਿਊਟਰ 'ਚ ਜੇ ਆਪਾਂ ਫੋਟੋ ਸੰਪਾਦਿਤ ਕਰਨੀ ਹੈ ਜਾਂ ਕਹਿ ਦਿੰਦੇ ਹਾਂ ਆਪਾਂ ਐਡਿਟ ਕਰਨੀ ਹੈ ਉਹਦੇ ਲਈ ਫੋਟੋਸ਼ੋਪ ਅਡੋਬ ਫੋਟੋਸ਼ੋਪ ਇੱਕ ਸੋਫਟਵੇਅਰ ਹੈ ਉਹਦੇ ਨਾਲ ਆਪਾਂ ਫੋਟੋ ਨੂੰ ਐਡਿਟ ਕਰ ਸਕਦੇ ਹਾਂ ਹੋਰ ਜ਼ਿਆਦਾ ਸੁੰਦਰ ਬਣਾ ਸਕਦੇ ਹਾਂ ਅਤੇ ਇਸ ਦੇ ਨਾਲ ਨਾਲ ਫੋਨ 'ਚ ਵੀ ਸੋਫਟਵੇਅਰ ਹੁੰਦੇ ਫੋਟੋ ਨੂੰ ਸੰਪਾਦਿਤ ਕਰਨ ਦੇ ਜਿਵੇਂ ਪਿਕਸ ਆਰਟ ਵਗੈਰਾ ਹੋ ਗਏ ਜਿਸ ਨਾਲ ਆਪਾਂ ਫੋਟੋ ਨੂੰ ਐਡਿਟ ਕਰ ਸਕਦੇ ਹਾਂ ਅਤੇ ਹੋਰ ਸੋਹਣੀ ਬਣਾ ਸਕਦੇ ਹਾਂ ਆਪਾਂ ਜਿੱਦਾਂ ਦੇਖਦੇ ਹਾਂ ਵੀ ਫੋਟੋ ਕਈ ਵਾਰ ਆਪਣੀ ਸੋਹਣੀ ਨਹੀਂ ਆਈ ਹੁੰਦੀ ਆਪਾਂ ਕਹਿੰਦੇ ਯਾਰ ਇਹਨੂੰ ਹੋਰ ਸੁੰਦਰ ਬਣਾਈਏ ਉਹ ਫਿਰ ਆਪਾਂ ਫ ਉਸ ਫੋਟੋ ਨੂੰ ਫੋਟੋ ਸ਼ੋਪ ਨਾਲ ਹੀ ਐਡਿਟ ਕਰਕੇ ਬਣਾ ਸਕਦੇ ਹਾਂ ਅਤੇ ਫੋਟੋਆਂ ਨੂੰ ਆਪਾਂ ਕੰਪਿਊਟਰ ਦੇ ਡਰਾਈਵ 'ਚ ਵੀ ਪਾ ਲਓ ਜਾਂ ਆਪਣੇ ਜੀਮੇਲ ਦੀ ਡਰਾਈਵ ਹੁੰਦੀ ਆ ਉਸ 'ਤੇ ਅਪਲੋਡ ਕਰ ਦਿਓ ਜਿਸ ਨਾਲ ਫੋਟੋ ਇਹ ਉੱਥੇ ਆਪਣੀ ਰਹੇਗੀ ਅਤੇ ਫੋਟੋ ਖਿੱਚਣਾ ਤਾਂ ਹਰੇਕ ਦਾ ਅੱਜ ਕੱਲ੍ਹ ਸ਼ੌਂਕ ਹੀ ਬਣ ਗਿਆ ਫੋਟੋ ਖਿੱਚ ਲੈਂਦੇ ਹਾਂ ਆਪਾਂ ਫਿਰ ਉਹਨੂੰ ਆਪਾਂ ਐਡਿਟ ਕਰਕੇ ਸੰਪਾਦਿਤ ਕਰਕੇ ਹੋਰ ਸੁੰਦਰ ਬਣਾ ਲੈਂਦੇ ਹਾਂ ਧੰਨਵਾਦ ਜੀ